ਮੈਂ ਅਤੁਲ ਗੁਰਦਾਸਪੁਰ ਦਾ ਰਹਿਣ ਵਾਲਾ ਹਾਂ ਪੰਜਾਬ ਵਿੱਚ ਖੇਤੀਬਾੜੀ ਸੈਕਟਰ ਨੂੰ ਦੇਖਦੇ ਹੋਏ ਮੈਂ ਕਹਿ ਸਕਦਾ ਹਨ ਕਿ ਇਹਦੇ ਬਹੁਤ ਹੀ ਜ਼ਿਆਦਾ ਦਿੱਕਤਾਂ ਹਨ ਕਿਸਾਨ ਆਪਣੀ ਪੂਰੀ ਕੋਸ਼ਿਸ਼ ਕਰਦੇ ਹਨ ਲੇਕਿਨ ਕਈ ਵਾਰੀ ਜ਼ਿਆਦਾ ਟੈਮਪਰੇਚਰ ਹੁੰਦੀ ਹੈ ਨਾ ਮੀਂਹ ਆਉਣ ਕਰਕੇ ਜਾਂ ਫਿਰ ਗਲਤ ਸਮੇਂ 'ਤੇ ਮੀਂਹ ਆਉਣ ਕਰਕੇ ਕਈ ਵਾਰ ਪੂਰੇ ਦੇ ਪੂਰੇ ਖੇਤ ਖਰਾਬ ਹੋ ਜਾਂਦੇ ਹਨ ਜਿਹਦੀ ਵਜ੍ਹਾ ਨਾਲ ਕਿਸਾਨਾਂ ਨੂੰ ਭਾਰੀ ਨੁਕਸਾਨ ਹੁੰਦਾ ਹੈ ਉਸ ਤੋਂ ਇਲਾਵਾ ਗਰੀਬੀ ਕਰਕੇ ਕਈ ਕਿਸਾਨ ਨਵੀਂ ਫਸਲ ਦੇ ਲਈ ਕਿਸੇ ਜਿਹੜੇ ਹੁੰਦੇ ਹਨ ਨਵੇਂ ਬੀਜ ਜਾਂ ਫਿਰ ਮਸ਼ੀਨਾਂ ਵੀ ਨਹੀਂ ਲੈ ਪਾਉਂਦੇ ਜਿਹਦੀ ਵਜ੍ਹਾ ਨਾਲ ਕਿ ਕਿਸਾਨ ਆਪਣੀ ਫਸਲ ਨੂੰ ਸਹੀ ਤਰੀਕੇ ਨਾਲ ਨਹੀਂ ਉਗਾ ਪਾਉਂਦੇ ਇਹਦਾ ਵੀ ਕਿਸਾਨਾਂ ਨੂੰ ਬਹੁਤ ਨੁਕਸਾਨ ਹੁੰਦਾ ਹੈ ਉਸ ਤੋਂ ਇਲਾਵਾ ਪੰਜਾਬ ਵਿੱਚ ਪਾਣੀ ਵੀ ਘੱਟ ਰਿਹਾ ਹੈ ਜਿਹਦੇ ਨਾਲ ਕਿ ਗਰਾਉਂਡ ਵੋਟਰ ਘੱਟ ਹੋਣ ਕਰਕੇ ਵੀ ਕਈ ਕਿਸਾਨਾਂ ਕੋਲ ਫਸਲਾਂ ਨੂੰ ਉਗਾਉਣ ਲਈ ਪਾਣੀ ਹੀ ਨਹੀਂ ਹੈ ਇਹੀ ਹਨ ਪੰਜਾਬ ਦੇ ਖੇਤੀਬਾੜੀ ਸੰਕਟ